ਹਾਂਜੀ ਕੌਣ ਹਾਂਜੀ ਸਤਿ ਸ਼੍ਰੀ ਅਕਾਲ ਕੌਣ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਥੈਂਕ ਯੂ ਹਾਂਜੀ ਹਾਂਜੀ ਥੈਂਕ ਯੂ ਹਾਂਜੀ ਹਾਂਜੀ ਬਿਲਕੁਲ ਜਿੱਦਾਂ ਤੁਸੀਂ ਜਿੰਨੀ ਮਿਹਨਤ ਕਰੋਗੇ ਉੰਨੇ ਕਾਮਯਾਬ ਹੋਵੋਗੇ ਜੇ ਤੁਸੀਂ ਘਰ ਬੈਠ ਕੇ ਕੁਛ ਵੀ ਨਹੀਂ ਕਰੋਗੇ ਔਰ ਇੱਦਾਂ ਕਹੋਗੇ ਕਿ ਜੋ ਹੋਵੇਗਾ ਦੇਖਿਆ ਜਾਵੇਗਾ ਫਿਰ ਤਾਂ ਗੱਲ ਥੋੜ੍ਹੀ ਨਾ ਬਣਦੀ ਹੈ ਹਾਂ ਜੀ ਨਹੀਂ ਕੁਛ ਨਹੀਂ ਹੁੰਦਾ ਬਸ ਸਟਰਗਲ ਕਰਨਾ ਹੁੰਦਾ ਲਾਈਫ 'ਚ ਹੋਰ ਕੁਛ ਵੀ ਨਹੀਂ ਹੁੰਦਾ ਧੋਖਾ ਨਹੀਂ ਇੱਦਾਂ ਦੇ ਕੰਮ ਹੀ ਨਹੀਂ ਕਰਨੇ ਜਿਹਦੇ ਨਾਲ ਧੋਖਾ ਮਿਲਦਾ ਹੈ ਅਗਰ ਆਪਣਾ ਕੰਮ ਕਰਨਾ ਸਟਰਗਲ ਕਰਨਾ ਅੱਛੇ ਕੰਮ ਕਰਨੇ ਬਸ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਾਏ ਬਿਲਕੁਲ ਬਾਏ ਬਾਏ ਓਕੇ ਬਾਏ